ਹੈਲੋ ਹਾਂਜੀ ਹਾਂਜੀ ਮੈਡਮ ਅੱਛਾ ਜੀ ਅੱਛਾ ਜੀ ਹਾਂਜੀ ਇਸ਼ਪ੍ਰੀਤ ਜੀ ਪੁੱਛੋ ਹਾਂਜੀ ਇਸ਼ਪ੍ਰੀਤ ਜੀ ਦੇਖੋ ਇੱਕ ਤੋਂ ਪਹਿਲਾਂ ਮੈਂ ਦੱਸਾਂ ਵੀ ਘੁੰਮਣ ਨੂੰ ਇਹ ਬਹੁਤ ਵਧੀਆ ਜਗ੍ਹਾ ਫਤਿਹਗੜ੍ਹ ਸਾਹਿਬ ਆਪਣਾ ਇੱਥੇ ਹਿਸਟੋਰੀਕਲ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਜੋਤੀ ਸਰੂਪ ਸਾਹਿਬ ਹੈ ਨਾ ਹੋਰ ਵੀ ਸਰਹੰਦ ਬਹੁਤ ਸਾਰੀਆਂ ਜਗ੍ਹਾ ਨੇ ਫਤਿਹਗੜ੍ਹ ਸਾਹਿਬ 'ਚ ਦੇਖਣ ਲਈ ਪਰ ਜਿਵੇਂ ਮੌਸਮ ਨੇ ਤੁਹਾਡੀ ਮੈਂ ਤੁਹਾਨੂੰ ਦੱਸਾਂ ਹੁਣ ਤੁਹਾਨੂੰ ਪਤਾ ਇੱਥੇ ਠੰਡ ਸ਼ੁਰੂ ਹੋ ਗਈ ਠੰਢ ਸ਼ੁਰੂ ਹੋਣ ਕਰਕੇ ਹਾਲੇ ਤਾਂ ਦੇਖੋ ਮੌਸਮ ਵਧੀਆ ਧੁੱਪ ਚੜਦੀ ਆ ਤੁਸੀਂ ਹਾਲੇ ਜ਼ਿਆਦਾ ਮੋਟੇ ਕੱਪੜਿਆਂ ਦੀ ਵੀ ਨਹੀਂ ਲੋੜ ਪੈਣੀ ਕਿ ਧੁੱਪ ਆਉਂਦੀ ਆ ਇਸ ਕਰਕੇ ਪਰ ਆਉਣ ਵਾਲੇ ਟਾਈਮ 'ਚ ਬਹੁਤ ਠੰਡ ਵੱਧ ਸਕਦੀ ਹੈ ਇਸ ਕਰਕੇ ਤੁਸੀਂ ਮੋਟੇ ਕੱਪੜੇ ਲੈ ਕੇ ਆਇਓ ਦੂਜੀ ਗੱਲ ਇਹ ਆ ਵੀ ਮੌਸਮ ਬਾਰਿਸ਼ ਵੀ ਹੁੰਦੀ ਹੈ ਨਾ ਮੌਸਮਾਂ 'ਚ ਹੈ ਨਾ ਤਾਂ ਇਸ ਕਰਕੇ ਬਾਰਿਸ਼ ਤੋਂ ਬਚਾਅ ਲਈ ਆਪਣਾ ਤੁਸੀਂ ਉਵੇਂ ਦੇ ਕੱਪੜੇ ਰੇਨ ਕੋਟ ਵਗੈਰਾ ਆਪਣਾ ਲੈ ਕੇ ਆਇਓ ਹੁਣ ਬੱਚਾ ਨਾਲ ਤਾਂ ਸਰਦੀਆਂ ਦੇ ਕੱਪੜੇ ਵੀ ਲੈ ਕੇ ਆਇਓ ਹੈ ਨਾ ਅਤੇ ਉਸ ਤੋਂ ਬਾਅਦ ਆਉਣ ਵਾਲੇ ਟਾਈਮ 'ਚ ਧੁੰਦਾਂ ਬਹੁਤ ਪੈਂਦੀਆ ਫਿਰ ਤੁਸੀਂ ਜਦੋਂ ਉਥੋਂ ਆਉਣਾ ਤਾਂ ਧੁੰਦ ਬਹੁਤ ਪੈਂਦੀਆਂ ਤੁਹਾਨੂੰ ਟਾਈਮ ਅਰ ਨਾਲ ਲੈ ਕੇ ਜਾਣਾ ਪੈਣਾ ਵੀ ਜਿੱਥੋਂ ਤੁਸੀਂ ਇੱਥੇ ਤੱਕ ਪਹੁੰਚ ਸਕੋ ਹੈ ਨਾ ਜੇ ਤੁਸੀਂ ਉਤਰਨਾ ਕਿੱਥੇ ਆ ਆਉਣਾ ਕਿੱਥੋਂ ਹੈ ਅੱਛਾ ਜੀ ਤਾਂ ਕੋਈ ਗੱਲ ਨਹੀਂ ਤੁਸੀਂ ਚੰਡੀਗੜਿਓ ਚੱਲਿਓ ਚੰਡੀਗੜ੍ਹੋਂ ਚੱਲ ਕੇ ਨਾ ਤੁਸੀਂ ਚੁੰਨੀ ਪਹੁੰਚ ਜਿਓ ਚੁੰਨੀ ਪਹੁੰਚ ਕੇ

ਹਾਂਜੀ ਹਾਂ ਹਾਂ ਕੋਈ ਗੱਲ ਨਹੀਂ ਤੁਸੀਂ ਚੁੰਨੀ ਪਹੁੰਚਿਓ ਜੀ ਚੁੰਨੀ ਤੋਂ ਬਾਅਦ ਮੈਂ ਲੋਕੇਸ਼ਨ ਭੇਜਦੂਗੀ ਉਥੋਂ ਮੈਂ ਤੁਹਾਨੂੰ ਚੱਕਲੂਂਗੀ ਫਿਰ ਚੁੰਨੀ ਤੋਂ ਬਾਅਦ ਮੈਂ ਤੁਹਾਨੂੰ ਫਤਿਹਗੜ੍ਹ ਸਾਹਿਬ ਲੈ ਲੈ ਜੋ ਠੀਕ ਹੈ ਜੀ ਅਤੇ ਹਾਂਜੀ ਹਾਂਜੀ ਬਸ ਆਪਾਂ ਮਿਲਦੇ ਹਾਂ ਫਿਰ ਇਸ਼ਪ੍ਰੀਤ ਓਕੇ ਜੀ ਠੀਕ ਹੈ ਜੀ ਓਕੇ ਓਕੇ ਓਕੇ